ਸੈਲਫ ਹੈਲਪ ਗਰੁੱਪ ਤੋਂ ਭਾਵ ਉਹ ਸੰਗਠਨ ਜਿਸ ਵਿੱਚ ਲੋਕ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਂਦੇ ਹਨ ਅਤੇ ਇੱਕ ਦੂਜੇ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਦੇ ਹਨ ਇਹ ਇੱਕ ਲੋਕਾਂ ਦਾ ਇਕੱਠ ਜਿਹਾ ਹੁੰਦਾ ਹੈ ਜਿਸ ਵਿੱਚ ਉਹ ਜ਼ਿਆਦਾਤਰ ਇੱਕੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਅਸਲ ਵਿੱਚ ਇਹ ਲੋਕਾਂ ਆਪਸ ਵਿੱਚ ਹੀ ਇੱਕ ਦੂਜੇ ਦੀ ਪ੍ਰੇਰਨਾ ਹੁੰਦੇ ਹਨ ਇਹ ਆਪਸ ਵਿੱਚ ਇੱਕ ਦੂਜੇ ਦਾ ਮਨੋਬਲ ਵਧਾਉਂਦੇ ਹਨ ਅਤੇ ਸਵੈ ਰੁਜ਼ਗਾਰ ਨੂੰ ਪ੍ਰੇਰਿਤ ਕਰਦੇ ਹਨ ਔਰਤਾਂ ਆਪਣੇ ਪੈਰਾਂ 'ਤੇ ਆਪ ਖੜੀਆਂ ਹੋ ਸਕਦੀਆਂ ਹਨ ਉਹ ਸਿਲਾਈ ਕਢਾਈ ਬਿਊਟੀ ਪਾਰਲਰ ਅਚਾਰ ਮੁਰੱਬੇ ਬਣਾਉਣਾ ਖਾਣਾ ਬਣਾਉਣਾ ਆਦਿ ਕਈ ਕੰਮ ਕਰਦੀਆਂ ਹਨ ਇਸ ਤੋਂ ਇਲਾਵਾ ਆਪਣੇ ਹੁਨਰ ਜਿਵੇਂ ਦਸਤਾਕਾਰੀ ਵਿੱਚ ਦਰੀਆਂ ਬਣਾਉਣਾ ਕਾਲੀਨ ਬਣਾਉਣਾ ਅਜਿਹੇ ਲਘੂ ਉਦਯੋਗ ਖੋਲ੍ਹ ਸਕਦੀਆਂ ਹਨ ਅੱਜ ਕੱਲ੍ਹ ਕਈ ਔਰਤ ਯੂਟਿਊਬ 'ਤੇ ਵੱਖ ਵੱਖ ਸਕਿਲਸ ਲੋਕਾਂ ਨੂੰ ਸਿਖਾ ਕੇ ਅੱਗੇ ਵੱਧ ਰਹੀਆਂ ਹਨ